ਮੇਰਾ ਸਭ ਤੋਂ ਯਾਦਗਾਰ ਬਾਈਕ ਅਨੁਭਵ ਉਹ ਸੀ ਜਦ ਮੈਂ ਪਹਿਲੀ ਵਾਰ ਆਪਦਾ ਬਾਈਕ ਚਲਾਇਆ ਸੀ ਉਹ ਮੇਰੇ ਲਈ ਇੰਨਾਂ ਖਾਸ ਕਿਉਂ ਸੀ ਕਿਉਂਕਿ ਉਹ ਮੇਰਾ ਆਪਦਾ ਬਾਈਕ ਸੀ ਉਸਨੂੰ ਚਲਾ ਕੇ ਮਨ ਨੂੰ ਜੋ ਖੁਸ਼ੀ ਹੋਈ ਸੀ ਉਹ ਸਭ ਤੋਂ ਯਾਦਗਾਰ ਸੀ ਅਤੇ ਉਹ ਪਲ ਮੈਂ ਜ਼ਿੰਦਗੀ ਵਿੱਚ ਕਦੇ ਵੀ ਨਹੀਂ ਭੁੱਲ ਸਕਦਾ ਇਹ ਅਨੁਭਵ ਮੈਨੂੰ ਮੇਰੇ ਲਈ ਬਹੁਤ ਖਾਸ ਸੀ